ਅਧਿਆਪਕਾਂ ਦੀ ਪਰਸ਼ਿਖਣ ਪ੍ਰਕਿਰਿਆ ਨੂੰ ਸੁਧਾਰਨ ਲਈ ਸਾਨੂੰ ਸਾਨੂੰ ਫਕੈਲਿਟੀ ਡਿਵੈਲਪਮੈਂਟ ਪ੍ਰੋਗਰਾਮ ਲਗਾਉਣੇ ਚਾਹੀਦੇ ਹਨ ਜਿਸ ਵਿੱਚ ਅਧਿਆਪਿਕਾ ਅਤੇ ਟੀਚਰਾਂ ਨੂੰ ਟਰੇਨਿੰਗ ਦਿੱਤੀ ਦੇਣੀ ਚਾਹੀਦੀ ਹੈ ਜਿਸ ਰਾਹੀਂ ਉਹ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਵਿੱਚ ਸੁਧਾਰ ਲੈ ਕੇ ਆਉਣ ਅਤੇ ਉਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਰਾਹੀਂ ਨੌਲੇਜ ਲੈ ਕੇ ਸੈਮੀਨਾਰ ਲਗਾਉਣੇ ਚਾਹੀਦੇ ਹਨ ਤਾਂਕਿ ਨੌਲੇਜ ਰਾਹੀਂ ਚੰਗੀ ਅਤੇ ਮੁਢਲੀ ਸਿੱਖਿਆ ਵਿੱਚ ਸੁਧਾਰ ਆ ਸਕੇ ਸਕੂਲਾਂ ਵਿੱਚ ਵਰਕਸ਼ਾਪ ਲਗਾਉਣੇ ਜਾਣ ਨਾਲ ਕਾਫੀ ਚੰਗੀ ਨੌਲੇਜ ਹਾਸਿਲ ਹੁੰਦੀ ਹੈ ਜਿਸ ਨਾਲ ਸਾਡੇ ਅਧਿਆਪਕ ਅਤੇ ਟੀਚਰ ਇਸ ਵਿੱਚ ਹਿੱਸਾ ਲੈਣ ਅਤੇ ਫਕੈਲਿਟੀ ਡਿਵੈਲਪਮੈਂਟ ਪ੍ਰੋਗਰਾਮ ਰਾਹੀਂ ਨੌਲੇਜ ਲੈ ਕੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਟੀਚਰ ਦੇ ਅਧਿਆਪਕ ਪਰਸ਼ਿੱਖਣ ਪ੍ਰਕਿਰਿਆ ਵਿੱਚ ਸੁਧਾਰ ਲੈ ਕੇ ਆਉਣ ਅਤੇ ਸਾਡੇ ਯੂਥ ਨੂੰ ਇਸ ਬਾਰੇ ਚੰਗੀ ਨੌਲੇਜ ਹਾਸਿਲ ਕਰਵਾ ਸਕਣ ਸਾਡੇ ਅੱਜ ਦੇ ਯੂਥ ਨੂੰ ਇਹਨਾਂ ਬਾਰੇ ਚੰਗੀ ਨੋਲੇਜ਼ ਲਿਆਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਵੇਖਣ ਨੂੰ ਆਇਆ ਹੈ ਕਿ ਹਰ ਗਵਰਮੈਟ ਸਕੂਲ ਦੇ ਅਧਿਆਪਕ ਜਾਂ ਟੀਚਰ ਵੱਧ ਤੋਂ ਵੱਧ ਚੰਗੀ ਸਿਕਸ਼ਾ ਤੋਂ ਜਾਣੂ ਨਹੀਂ ਹੁੰਦੇ ਉਹਨਾਂ ਨੂੰ ਇਹਨਾਂ ਸ਼ਿਕਸ਼ਾ ਤੋਂ ਜਾਣੂ ਕਰਾਉਣ ਲਈ ਸਾਨੂੰ ਫਕੈਲਿਟੀ ਡਿਵੈਲਪਮੈਂਟ ਪ੍ਰੋਗਰਾਮ ਲਗਵਾਉਣੇ ਚਾਹੀਦੇ ਹਨ ਤਾਂਕਿ ਉਹ ਹਰ ਸਕੂਲ ਵਿੱਚ ਵਰਕਸ਼ੋਪ ਆਦਿ ਲਗਾ ਕੇ ਹਰ ਟੀਚਰ ਨੂੰ ਟਰੇਨਿੰਗ ਦੇਣ ਤਾਂ ਕਿ ਉਹ ਵੱਧ ਤੋਂ ਵੱਧ ਨੌਲੇਜ ਵੰਡਣ